ਸਤਿ ਸ਼੍ਰੀ ਅਕਾਲ ਮੈਡਮ ਜੀ ਮੈਡਮ ਜੀ ਮਤਲਬ ਕਿ ਸਾਡੇ ਘਰ ਕੋਈ ਫੰਕਸ਼ਨ ਹੈ ਅਤੇ ਅਸੀਂ ਤੁਸੀਂ ਥੋੜ੍ਹੇ ਸੁਨਿਆਰੇ ਹੋ ਬਣਾਉਣਾ ਹੈ ਗਹਿਣੇ ਗੁਹਣੇ ਬਣਾਉਣੇ ਹੈ ਅ ਮੈਡਮ ਜੀ ਮੇਰੇ ਹਸਬੈਂਡ ਵਾਸਤੇ ਚੈਨੀ ਅਤੇ ਨਾਲ ਮੁੰਦਰੀ ਬਣਾਉਣੀ ਆ ਹਾਂ ਤੋਲੇ ਦੀ ਚੈਨ ਅਤੇ ਅੱਧੇ ਤੋਲੇ ਦੀ ਮੁੰਦਰੀ ਬਣਾ ਦਿਓ ਅਤੇ ਕੀ ਇਹਦਾ ਮਤਲਬ ਕਿ ਖਰਚਾ ਖੁਰਚਾ ਦੱਸ ਦਿਓ ਸਾਨੂੰ ਕਿੰਨਾ ਕਰ ਆਂਦਾ ਨਹੀਂ ਮੈਡਮ ਜੀ ਮਤਲਬ ਕਿ ਅਸੀਂ ਅੱਗੇ ਵੀ ਆਉਂਦੇ ਹਾਂ ਤੁਹਾਡੀ ਦੁਕਾਨ 'ਤੇ ਅਤੇ ਤੁਸੀਂ ਆਪਣਾ ਮਤਲਬ ਕਿ ਘੱਟ ਕਰਕੇ ਸਾਨੂੰ ਦੱਸ ਦਿਓ ਠੀਕ ਹੈ